ਕੋਵਿਡ ਦੀ ਮਹਾਮਾਰੀ ਕਾਰਨ ਬੱਚਿਆਂ ਦੀ ਸਿੱਖਿਆ ਉੱਤੇ ਬਹੁਤ ਹੀ ਜ਼ਿਆਦਾ ਅਸਰ ਪਿਆ ਹੈ ਕਿਉਂਕਿ ਸਕੂਲ ਬੰਦ ਹੋ ਗਏ ਸਨ ਅਤੇ ਬੱਚਿਆਂ ਦੀ ਪੜ੍ਹਾਈ ਔਨਲਾਈਨ ਸ਼ੁਰੂ ਹੋ ਗਈ ਸੀ ਔਨਲਾਈਨ ਪੜ੍ਹਾਈ ਵਿੱਚ ਬੱਚਿਆਂ ਨੂੰ ਬਹੁਤ ਹੀ ਚੀਜ਼ਾਂ ਜੋ ਕਿ ਸਮਝ ਨਹੀਂ ਸੀ ਆਉਂਦੀਆਂ ਕਿਸੇ ਕੋਲ ਫੋਨ ਦੀ ਮੌਜੂਦਗੀ ਨਾ ਹੋਣ ਕਾਰਨ ਉਹਨਾਂ ਦੀ ਸਿੱਖਿਆ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਜਿਵੇਂ ਕਿ ਘਰ ਵਿੱਚ ਦੋ ਬੱਚੇ ਹਨ ਅਤੇ ਇੱਕ ਫੋਨ ਹਨ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿ ਕਿਹੜਾ ਬੱਚਾ ਕਿਸ ਸਮੇਂ ਆਪਣੀ ਕਲਾਸ ਲਗਾਵੇ ਇਸ ਕਾਰਨ ਬੱਚਿਆਂ ਦੀ ਸਿੱਖਿਆ ਬਹੁਤ ਹੀ ਜ਼ਿਆਦਾ ਪਿੱਛੇ ਰਹਿ ਗਈ ਹੈ